ਹੈਲੋ ਤੁਸੀਂ ਫੋਰੈਸਟ ਡਿਪਾਰਟਮੈਂਟ ਤੋਂ ਗੱਲ ਕਰਦੇ ਹੋ ਐਕਚੁਲੀ ਨਾ ਮੈਂ ਪੁੱਛਣਾ ਸੀ ਵੀ ਮੈਂ ਘਰ ਵਿੱਚ ਨਾ ਔਰਗੈਨਿਕ ਤਰੀਕੇ ਦੇ ਨਾਲ ਸਬਜ਼ੀਆਂ ਵਗੈਰਾ ਉਗਾਉਣ ਦਾ ਸੋਚ ਰਹੀ ਸੀ ਕਿ ਤੁਸੀਂ ਮੈਨੂੰ ਕੁਛ ਕੁ ਵੀ ਮਤਲਬ ਦੱਸ ਸਕਦੇ ਹੋ ਵੀ ਆਪਾਂ ਫਲ ਅਤੇ ਸਬਜ਼ੀਆਂ ਕਿਵੇਂ ਕੀ ਪ੍ਰੋਸੀਜਰ ਹੈਗਾ ਇਹਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਠੀਕ ਹੈ ਹਾਂਜੀ ਠੀਕ ਹੈ ਵੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂਜੀ ਮੈਂ ਪਿਛਲੀ ਵਾਰ ਮਤਲਬ ਕਿ ਜਿਵੇਂ ਪੌਦੇ ਉਗਾਏ ਸੀਗੇ ਬਟ ਉਹ ਕੀ ਹੈਗਾ ਸੜ ਸੜ ਗਏ ਸੀਗੇ ਚੱਲੇ ਨਹੀਂ ਸੀ ਅਤੇ ਉਹ ਜਾਂ ਫਿਰ ਉਹਦਾ ਇਹੀ ਰੀਜਨ ਹੋਇਆ ਹੋਊਗਾ ਵੀ ਮੈਂ ਖਾਦ ਜ਼ਿਆਦਾ ਪਾ ਤੀ ਹੋਊਗੀ ਜਾਂ ਕੇਅਰ ਨਹੀਂ ਹੋਈ ਹੋਣੀ ਹੈ ਨਾ ਠੀਕ ਹੈ ਜੀ ਠੀਕ ਹੈ ਹਾਂਜੀ ਚਲੋ ਹਾਂਜੀ ਠੀਕ ਹੈ ਥੈਂਕ ਯੂ